ਸਤਿ ਸ਼੍ਰੀ ਅਕਾਲ ਜੀ ਹਾਂ ਮੈਂ ਦਿਵਾਲੀ ਦੇ ਤਿਉਹਾਰ 'ਤੇ ਮਾਤਾ ਲਕਸ਼ਮੀ ਜੀ ਦੀ ਮੂਰਤੀ ਬਣਾਉਣ ਦਾ ਇਰਾਦਾ ਸੋਚਿਆ ਵੈਸੇ ਤਾਂ ਦਿਵਾਲੀ ਦੇ ਤਿਉਹਾਰ 'ਤੇ ਰੰਗ ਲੈ ਕੇ ਰੰਗੋਲੀਆਂ ਬਣਾਉਣ ਦਾ ਮੈਨੂੰ ਬਹੁਤ ਸ਼ੌਂਕ ਸੀ ਪਰ ਮੈਂ ਸੋਚਿਆ ਕਿਉਂ ਨਾ ਐਤਕੀਂ ਕੁਛ ਵੱਖਰਾ ਹੀ ਕੀਤਾ ਜਾਵੇ ਫਿਰ ਮੈਂ ਬਾਜ਼ਾਰੋਂ ਕਲੇਅ ਲਿਆਂਦੀ ਅਲੱਗ ਅਲੱਗ ਰੰਗ ਵਿੱਚ ਪੰਜ ਸੱਤ ਕਲਰ ਮੈਨੂੰ ਕਲੇਅ ਦੇ ਮਿਲ ਗਏ ਉਹ ਮੈਂ ਲੈ ਕੇ ਘਰ ਆਈ ਮੂਰਤੀ ਮਾਤਾ ਲਕਸ਼ਮੀ ਜੀ ਦੀ ਫੋਟੋ ਦਾ ਮੈਂ ਮੋਬਾਈਲ 'ਚੋਂ ਇੱਕ ਪੇਜ਼ ਕੱਢਿਆ ਤੇ ਉਸ ਨੂੰ ਦੇਖ ਕੇ ਕਲੇਅ ਦੇ ਨਾਲ ਲਕਸ਼ਮੀ ਮਾਤਾ ਦੀ ਮੂਰਤੀ ਬਣਾਉਣ ਲੱਗੀ ਮੇਰਾ ਮਨ ਇੰਨਾ ਖੁਸ਼ ਨਾ ਹੋਇਆ ਕਿਉਂਕਿ ਮੂਰਤੀ ਇੰਨੀ ਚੰਗੀ ਨਹੀਂ ਬਣੀ ਸੀ ਮੈਂ ਫਿਰ ਦੁਬਾਰਾ ਫਿਰ ਕੋਸ਼ਿਸ਼ ਕੀਤੀ ਮੈਨੂੰ ਥੋੜ੍ਹੀ ਜਿਹੀ ਤਸੱਲੀ ਹੋਈ ਕਿ ਹੁਣ ਮੂਰਤੀ ਥੋੜ੍ਹੀ ਸਹੀ ਬਣ ਰਹੀ ਸੀ ਮੈਂ ਮੂਰਤੀ ਨੂੰ ਬਣਾਇਆ ਚੰਗੀ ਤਰ੍ਹਾਂ ਉਹ ਨੂੰ ਤਰਾਸ਼ਿਆ ਤਰਾਸ਼ ਕੇ ਫਿਰ ਮੈਂ ਕਲਰ ਲਏ ਫਿਰ ਮੈਂ ਸੋਚਿਆ ਕਿ ਕਲਰ ਕਰ ਕੇ ਇਹ ਹੋਰ ਵੀ ਜ਼ਿਆਦਾ ਸੁੰਦਰ ਲਗੇਗੀ ਅਤੇ ਮਾਂ ਲਕਸ਼ਮੀ ਦੀ ਮੂਰਤੀ ਨੂੰ ਮੈਂ ਅਲੱਗ ਅਲੱਗ ਰੰਗਾਂ ਨਾਲ ਉਸ ਦੇ ਕੱਪੜਿਆਂ ਨੂੰ ਸਜਾਇਆ ਸੁਨਹਿਰੇ ਰੰਗ ਨਾਲ ਉਸ 'ਤੇ ਗਹਿਣਿਆਂ ਨੂੰ ਸ਼ਿੰਗਾਰਿਆ ਜਦੋਂ ਮੂਰਤੀ ਪੂਰੀ ਬਣ ਕੇ ਤਿਆਰ ਹੋਈ ਤਾਂ ਸਾਰਿਆਂ ਨੇ ਦੇਖਿਆ ਮੂਰਤੀ ਬਹੁਤ ਹੀ ਸੁੰਦਰ ਲੱਗ ਰਹੀ ਸੀ ਜਿਵੇਂ ਸੱਚਮੁੱਚ ਹੀ ਬਾਜ਼ਾਰ ਤੋਂ ਕਿਸੇ ਨੇ ਖੁਦ ਬਣਾਈ ਹੋਵੇ ਇਹ ਨਹੀਂ ਲੱਗ ਰਿਹਾ ਸੀ ਕਿ ਇਹ ਪਹਿਲੀ ਵਾਰ ਹੀ ਬਣਾਈ ਹੋਈ ਮੂਰਤੀ ਹੈ ਮੈਨੂੰ ਆਪਣੇ ਆਪ ਵਿੱਚ ਖੁਸ਼ੀ ਵੀ ਬਹੁਤ ਹੋ ਰਹੀ ਸੀ ਕਿਉਂਕਿ ਮੈਂ ਪਹਿਲੀ ਵਾਰੀ ਸੋਚਿਆ ਸੀ ਅਤੇ ਪਹਿਲੀ ਵਾਰੀ ਮੈਂ ਉਸ ਮੂਰਤੀ ਨੂੰ ਬਣਾਉਣ ਵਿਚ ਕਾਮਯਾਬ ਹੋ ਗਈ ਸਾਂ ਵੈਸੇ ਤਾਂ ਰੰਗੋਲੀਆਂ ਵੀ ਬਹੁਤ ਸੋਹਣੀਆਂ ਬਣਾ ਲੈਂਦੀ ਸਾਂ ਪਰ ਮੂਰਤੀ ਦਾ ਤਜਰਬਾ ਹੀ ਮੇਲਾ ਮੇਰਾ ਪਹਿਲਾ ਤਜਰਬਾ ਸੀ ਜਿਸ ਵਿੱਚ ਮੈਨੂੰ ਸਫ਼ਲਤਾ ਹਾਸਲ ਹੋਈ ਮੇਰੇ ਘਰ ਦੇ ਪਰਿਵਾਰ ਦੇ ਮੈਂਬਰਾਂ ਨੇ ਜਦੋਂ ਉਸ ਮੂਰਤ ਨੂੰ ਵੇਖਿਆ ਤਾਂ ਉਹ ਵੀ ਹੈਰਾਨ ਹੋ ਗਏ ਧੰਨਵਾਦ